ਪਸ਼ੂਆਂ ਤੋਂ ਬੜੀ ਸਾਰੀ ਜਾਣਕਾਰੀ ਮਿਲਦੀ ਹੈ ਉਹਨਾਂ ਦੇ ਬਹੁਤ ਸਾਰੇ ਇਸ਼ਾਰੇ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੋਟ ਕਰਨ ਵਾਲੀਆਂ ਜਿਹਨਾਂ ਤੋਂ ਪਤਾ ਲੱਗਦਾ ਕਿ ਪਸ਼ੂ ਦੀ ਸਿਹਤ ਸਹੀ ਨਹੀਂ ਹੈ ਉਹ ਸਹੀ ਤਰੀਕੇ ਨਾਲ ਚਾਰਾ ਨਹੀਂ ਖਾਂਦਾ ਉਹ ਵਾਰ ਵਾਰ ਬੈਠ ਰਿਹਾ ਹੈ ਉਹ ਪੈਰ ਨਾਲ ਮਿੱਟੀ ਨੂੰ ਪਿੱਛੇ ਸੁੱਟ ਰਿਹਾ ਹੈ ਉਸ ਦੇ ਮੂੰਹ ਦੇ ਵਿੱਚੋਂ ਪਾਣੀ ਗਿਰ ਰਿਹਾ ਹੈ ਇੱਕ ਉਹ ਸੁਸਤੀ ਮਹਿਸੂਸ ਕਰ ਰਿਹਾ ਹੈ ਉਸ ਨੂੰ ਜਿਹੜਾ ਕੀ ਕੰਬਣੀ ਛਿੜੀ ਹੋਈ ਹੈ ਕੰਬ ਰਿਹਾ ਹੈ ਪਸ਼ੂ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਆ ਕਿ ਉਸਨੂੰ ਬੁਖਾਰ ਵੀ ਹੋ ਸਕਦਾ ਉਸਨੂੰ ਮੂੰਹ ਖੁਰ ਦੀ ਬਿਮਾਰੀ ਹੋ ਸਕਦੀ ਹੈ ਉਸ ਨੂੰ ਚਮੜੀ ਦੀ ਇੱਕ ਬਿਮਾਰੀ ਹੋ ਸਕਦੀ ਹੈ ਇਸ ਕਰਕੇ ਪਸ਼ੂਆਂ ਦੀਆਂ ਇਸ਼ਾਰਿਆਂ ਤੋਂ ਜਾਂ ਉਹਨਾਂ ਦੇ ਸਿਮਟਮ ਤੋਂ ਅਸੀਂ ਬੜਾ ਕੁਝ ਜਾਣ ਸਕਦੇ ਹਾਂ